ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਅਸੀਂ ਜੀਵਨ ਜੀਣ ਲਈ ਜ਼ਿੰਦਗੀ ਵਿੱਚ ਕੁਛ ਨਾ ਕੁਛ ਕਰਦੇ ਹਾਂ ਰੋਜ਼ੀ ਰੋਟੀ ਕਮਾਉਣ ਲਈ ਆਪਾਂ ਨੂੰ ਕੋਈ ਨਾ ਕੋਈ ਮਾਰਗ ਤਹਿ ਕਰਨਾ ਪੈਂਦਾ ਹੈ ਜ਼ਿੰਦਗੀ ਜੀਣ ਲਈ ਇਹ ਗੱਲਾਂ ਜ਼ਰੂਰੀ ਹਨ ਅਸੀਂ ਜ਼ਿੰਦਗੀ ਜਿਊਣ ਲਈ ਕੋਈ ਨਾ ਕੋਈ ਜ਼ਿੰਦਗੀ ਦੇ ਚਾਅ ਨਾਲ਼ ਨਾਲ਼ ਚੱਲਣ ਵਾਲਾ ਮਾਰਗ ਚਾਹੁੰਦੇ ਹਾਂ ਜ਼ਿੰਦਗੀ ਜੀਣ ਲਈ ਰੋਜ਼ੀ ਰੋਟੀ ਕਮਾਉਣੀ ਬਹੁਤ ਜ਼ਰੂਰੀ ਹੈ ਆਪਾਂ ਆਪਣੇ ਸ਼ੌਕ ਦੇ ਨਾਲ਼ ਨਾਲ਼ ਰੋਜ਼ੀ ਰੋਟੀ ਵੀ ਕਮਾ ਸਕਦੇ ਹਾਂ ਜਿਸ ਤਰ੍ਹਾਂ ਮੈਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਬੜਾ ਸ਼ੌਕ ਸੀ ਬਚਪਨ ਤੋਂ ਹੀ ਮੈਨੂੰ ਅਧਿਆਪਕ ਬਣਨ ਦਾ ਬੜਾ ਸ਼ੌਕ ਸੀ ਮੈਂ ਬਾਰਵੀਂ ਤੋਂ ਬਾਅਦ ਐੱਮ ਏ ਬੀ ਏ ਕੀਤੀ ਜੋ ਕਿ ਮੈਂ ਬੜੇ ਹੀ ਸ਼ੌਕ ਦੇ ਨਾਲ਼ ਕੀਤੀ ਬੜੇ ਹੀ ਵਧੀਆ ਨੰਬਰ ਲੈ ਕੇ ਪਾਸ ਹੋਈ ਮੇਰੇ ਮਾਂ ਬਾਪ ਨੇ ਮੈਨੂੰ ਪੜ੍ਹਨ ਦਾ ਬਹੁਤ ਹੀ ਵਧੀਆ ਹੁਨਰ ਦਿੱਤਾ ਐੱਮ ਏ ਕਰਨ ਤੋਂ ਬਾਅਦ ਮੈਂ ਸਕੂਲ ਵਿੱਚ ਪ੍ਰਾਈਵੇਟ ਅਧਿਆਪਕ ਦੀ ਨੌਕਰੀ ਕੀਤੀ ਇਸ ਤੋਂ ਬਾਅਦ ਮੈਂ ਹੁਣ ਬੱਚਿਆਂ ਨੂੰ ਨਾਲ਼ ਨਾਲ਼ ਟਿਊਸ਼ਨ ਵੀ ਪੜ੍ਹਾ ਰਹੀ ਹਾਂ ਟਿਊਸ਼ਨ ਦੇ ਨਾਲ਼ ਨਾਲ਼ ਮੇਰੀ ਰੋਜ਼ੀ ਰੋਟੀ ਵੀ ਵਧੀਆ ਚੱਲ ਰਹੀ ਹੈ ਅਤੇ ਨਾਲ਼ ਹੀ ਮੇਰਾ ਬੱਚਿਆਂ ਨੂੰ ਪੜ੍ਹਾਉਣ ਦਾ ਸ਼ੌਕ ਪੂਰਾ ਹੋ ਰਿਹਾ ਹੈ ਆਪਾਂ ਨੂੰ ਆਪਣਾ ਸ਼ੌਕ ਇਹੋ ਜਿਹਾ ਰੱਖਣਾ ਚਾਹੀਦਾ ਹੈ ਕਿ ਜਿਸਦੇ ਨਾਲ਼ ਨਾਲ਼ ਆਪਣਾ ਘਰ ਪਰਿਵਾਰ ਚੱਲ ਸਕੇ ਆਪਾਂ ਜ਼ਿੰਦਗੀ ਦੇ ਫੈਸਲੇ ਕਰ ਸਕੀਏ ਆਪਾਂ ਜ਼ਿੰਦਗੀ ਦੇ ਨਾਲ਼ ਨਾਲ਼ ਸਾਰੇ ਸ਼ੌਕ ਪੂਰੇ ਕਰ ਸਕੀਏ